ਅੱਜ ਕੱਲ੍ਹ ਅੱਗੇ ਤੋਂ ਅੱਗੇ ਬੰਦੇ ਜੋੜ ਕੇ ਚੇਨ ਬਣਾ ਕੇ ਬਿਜ਼ਨਸ ਕਰਨ ਦਾ ਚਲਨ ਬਹੁਤ ਹੋ ਗਿਆ ਹੈ ਉਹ ਅੱਜ ਦੀ ਜਨਰੇਸ਼ਨ ਨੂੰ ਸ਼ਾਇਦ ਸੁਖਾਲਾ ਲੱਗਦਾ ਹੈ ਕਿਉਂਕਿ ਤੁਸੀਂ ਕਿਤੇ ਬਾਹਰ ਨਹੀਂ ਜਾਣਾ ਤੁਸੀਂ ਕਿਤੇ ਬਾਹਰ ਦੁਕਾਨ ਬਣਾ ਕੇ ਨਹੀਂ ਬੈਠਣੀ ਆਪਣੇ ਘਰ ਤੋਂ ਹੀ ਤੁਸੀਂ ਆਪਰੇਟ ਕਰ ਸਕਦੇ ਹੋ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਅੱਗੇ ਤੀਸਰਾ ਇਸ ਤਰ੍ਹਾਂ ਜੁੜ ਕੇ ਚੇਨ ਬਣ ਜਾਂਦੀ ਹੈ ਅਤੇ ਤੁਹਾਡੀ ਜਿਹੜੀ ਜੋ ਬਿਜਨਸ ਤੁਸੀਂ ਕਰ ਰਹੇ ਹੋ ਜੋ ਵੀ ਆਈਟਮ ਤੁਸੀਂ ਸੇਲ ਕਰ ਰਹੇ ਹੋ ਉਹ ਉੱਥੋਂ ਚੇਨ ਦੇ ਰਾਹੀਂ ਹੀ ਆਪਣੇ ਗਾਹਕ ਤੱਕ ਪਹੁੰਚ ਜਾਂਦੀ ਹੈ ਬਿਜ਼ਨਸ ਇਸ ਤਰ੍ਹਾਂ ਠੀਕ ਹੈ ਕਿ ਤੁਸੀਂ ਕਿਤੇ ਬਹੁਤ ਭੱਜ ਦੌੜ ਤੁਹਾਨੂੰ ਨਹੀਂ ਕਰਨੀ ਪੈਂਦੀ ਸਿਰ ਖਪਾਈ ਬਹੁਤ ਜ਼ਿਆਦਾ ਨਹੀਂ ਕਰਨੀ ਪੈਂਦੀ ਲੇਕਿਨ ਇਹਦੇ 'ਚ ਕੋਈ ਵੀ ਉਸ ਚੇਨ 'ਚ ਜੇ ਕੋਈ ਗਲਤ ਕੜੀ ਆ ਗਈ ਕੋਈ ਗਲਤ ਵਿਅਕਤੀ ਉਹਦੇ 'ਚ ਆ ਗਿਆ ਤਾਂ ਉਹ ਬਿਜ਼ਨਸ ਬਰਬਾਦ ਵੀ ਹੋ ਸਕਦਾ ਹੈ ਅਤੇ ਤੁਸੀਂ ਨੁਕ ਨੁਕਸਾਨ ਵੀ ਉਠਾ ਸਕਦੇ ਹੋ